ਮੈਂ ਕਦੇ ਵੀ ਕਿਸੇ ਕਲਾਕਾਰੀ ਕਲਾ ਪ੍ਰਦਰਸ਼ਨੀ ਦੀ ਨਹੀਂ ਦੇਖੀ ਪਰ ਮੈਂ ਇਹ ਜ਼ਰੂਰ ਦੇਖਣਾ ਚਾਹੁੰਦੀ ਹਾਂ ਕਿਉਂਕਿ ਮੈਂ ਖੁਦ ਇੱਕ ਕਲਾਕਾਰ ਹਾਂ ਚਿੱਤਰਕਲਾ ਦੀ ਕਲਾਕਾਰ ਹਾਂ ਅਤੇ ਇਹ ਦੇ ਸਾਡੇ ਲਈ ਦੇਖਣਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਕਲਾਕਾਰੀ ਚਿੱਤਰਕਲਾ ਵਿੱਚੋਂ ਸਾਨੂੰ ਵੱਖ ਵੱਖ ਰੁਚੀ ਮਤਲਬ ਗਿਆਨ ਪ੍ਰਾਪਤ ਹੁੰਦਾ ਹੈ ਅਸੀਂ ਕਿਸ ਤਰ੍ਹਾਂ ਵੱਖ ਵੱਖ ਚਿੱਤਰ ਚਿੱਤਰ ਸਕਦੇ ਹਨ ਵੱਖ ਵੱਖ ਚਿੱਤਰ ਜੋ ਕਿ ਬਣਾ ਸਕਦੇ ਹਾਂ ਇਹਨਾਂ ਬਾਰੇ ਸਾਨੂੰ ਵੱਖ ਵੱਖ ਜੋ ਕਿ ਹੈ ਸਾਨੂੰ ਸੋਲਿਊਸ਼ਨ ਮਿਲਦੇ ਹੈ ਕਿ ਕਿਸ ਤਰ੍ਹਾਂ ਆਪਾਂ ਚਿੱਤਰ ਚਿੱਤਰ ਸਕਦੇ ਹਾਂ ਪਰ ਮੈਂ ਇੱਥੇ ਜ਼ਰੂਰ ਜਾਨਣਾ ਚਾਹਵਾਂਗੀ